ਮੈਂ ਇਹ ਸੋਚਦਾ ਹਾਂ ਕਿ ਕੋਈ ਵੀ ਭਾਸ਼ਾ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਉਸੇ ਤਰ੍ਹਾਂ ਹੀ ਪੰਜਾਬੀ ਭਾਸ਼ਾ ਭਾਰਤ ਦੀ ਸਰਕਾਰੀ ਭਾਸ਼ਾ ਹਿੰਦੀ ਨਾਲ ਤੁਲਨਾ ਨਹੀਂ ਕਰਦੀ ਭਾਸ਼ਾ ਸਿਰਫ ਮੈਸਿਜ਼ ਨੂੰ ਐਕਸਚੇਂਜ ਕਰਨ ਲਈ ਵਰਤੀ ਜਾਂਦੀ ਹੈ ਜਾਂ ਆਪਣੀ ਫੀਲਿੰਗਜ ਨੂੰ ਐਕਸਪ੍ਰੈਸ ਕਰਨ ਲਈ ਵਰਤੀ ਜਾਂਦੀ ਹੈ ਸਾਨੂੰ ਸਾਰੀਆਂ ਭਾਸ਼ਾ ਦੀ ਹੀ ਰਿਸਪੈਕਟ ਕਰਨੀ ਚਾਹੀਦੀ ਹੈ ਸਾਰੀਆਂ ਭਾਸ਼ਾਵਾਂ ਹੀ ਇੱਕੋ ਜਿਹੀ ਅਹਿਮੀਅਤ ਰੱਖਦੀਆਂ ਹਨ ਸਾਰੀਆਂ ਭਾਸ਼ਾ ਵੀ ਜ਼ਰੂਰੀ ਹਨ ਅਤੇ ਸਾਰੀਆਂ ਭਾਸ਼ਾਵਾਂ ਸਾਨੂੰ ਆਉਣੀਆਂ ਵੀ ਚਾਹੀਦੀਆਂ ਹਨ ਇਹੀ ਇੱਕ ਚੰਗਾ ਨਾਗਰਿਕ ਦੀ ਰਿਸਪੋਂਸੀਬਿਲਟੀ ਹੈ ਸੋ ਹਿੰਦੀ ਭਾਸ਼ਾ ਸਾਡੀ ਰਾਸ਼ਟਰ ਭਾਸ਼ਾ ਹੈ ਸਾਨੂੰ ਇਸਦੀ ਬਹੁਤ ਇੱਜ਼ਤ ਕਰਨੀ ਚਾਹੀਦੀ ਹੈ ਪੰਜਾਬੀ ਭਾਸ਼ਾ ਵੀ ਇੱਕ ਆਪਣੀ ਵੱਖਰੀ ਅਹਿਮੀਅਤ ਰੱਖਦੀ ਹੈ ਲੇਕਿਨ ਇਹ ਡਿਪੈਂਡ ਕਰਦਾ ਹੈ ਕਿ ਵੱਖਰੇ ਵੱਖਰੇ ਕਲਚਰ ਦੇ ਵਿੱਚ ਕਿਹੜੀ ਭਾਸ਼ਾ ਚਲਦੀ ਹੈ ਸੋ ਇਹਦੇ ਵਿੱਚ ਕੋਈ ਤੁਲਨਾ ਵਾਲੀ ਚੀਜ਼ ਨਹੀਂ ਹੈਗੀ ਸਾਰੇ ਧਰਮਾਂ ਦੇ ਵਿੱਚ ਵੱਖਰੀ ਵੱਖਰੀ ਭਾਸ਼ਾਵਾਂ ਚਲਦੀਆਂ ਹਨ ਸਾਰੇ ਸ਼ਹਿਰਾਂ ਦੇ ਵਿੱਚ ਸਾਰੀ ਸਟੇਟਸ ਦੇ ਵਿੱਚ ਵੱਖਰੀ ਵੱਖਰੀ ਭਾਸ਼ਾਵਾਂ ਚਲਦੀਆਂ ਹਨ ਕਿਸੇ ਦੀ ਵੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਸਾਡੀ ਰਾਸ਼ਟਰ ਭਾਸ਼ਾ ਹਿੰਦੀ ਹੈ ਸਾਨੂੰ ਬੜੇ ਰਿਸਪੈਕਟ ਨਾਲ ਹਿੰਦੀ ਭਾਸ਼ਾ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਵੀ ਓਨੀ ਅਹਿਮੀਅਤ ਹੀ ਦੇਣੀ ਚਾਹੀਦੀ ਹੈ